ਭਾਰਤ ਵਿੱਚ ਸਭ ਤੋਂ ਜਿਹੜੀ ਵੱਧ ਪੀਣ ਵਾਲੀ ਚੀਜ਼ ਹੈ ਉਹ ਚਾਹ ਹੈ ਕਿਉਂਕਿ ਚਾਹ ਜਿਹੜੀ ਹੈਗੀ ਹੈ ਉਹ ਕਾਫ਼ੀ ਟਾਈਮ ਤੋਂ ਲੋਕ ਪੀਂਦੇ ਹਨ ਘਰ ਘਰਾਂ ਵਿੱਚ ਦੋ ਦੋ ਤਿੰਨ ਤਿੰਨ ਵਾਰ ਲੋਕ ਚਾਹ ਪੀਂਦੇ ਆ ਕਈ ਤਾਂ ਚਾਹ ਦੇ ਬਿਲਕੁਲ ਆਦੀ ਹੋ ਜਾਂਦੇ ਹਨ ਉਹ ਚਾਹ ਬਿਲਕੁਲ ਮੈਂ ਕਹਿੰਦਾ ਛੇ ਵਾਰੀ ਚਾਹ ਪੀ ਲੈਣਗੇ ਦਿਨ 'ਚ ਚਾਹ ਹਰ ਘਰ ਵਿੱਚ ਅਲੱਗ ਤਰੀਕੇ ਨਾਲ ਬਣਦੀ ਹੈ ਜਿੱਦਾਂ ਹੁਣ ਕਈ ਲੋਕ ਜਿੱਦਾਂ ਹੁਣ ਬਾਹਰ ਦੀ ਗੱਲ ਕਰੀਏ ਆਪਾਂ ਬਾਹਰ ਵਿੱਚ ਚਾ ਚਾਹ ਪੀਂਦੇ ਹੀ ਨਹੀਂ ਹਨ ਬਲੈਕ ਟੀ ਪੀਂਦੇ ਹਨ ਉਹ ਦੁੱਧ ਨਹੀਂ ਪਾਉਂਦੇ ਸਿਰਫ਼ ਪੱਤੀ ਅਤੇ ਪਾਣੀ ਨੂੰ ਉਬਾਲ ਦਿੰਦੇ ਹਨ ਅਤੇ ਉਹ ਬਲੈਕ ਟੀ ਪੀਂਦੇ ਹਨ ਸਾਡੇ ਇੱਥੇ ਵੀ ਕਈ ਲੋਕੀ ਬਲੈਕ ਟੀ ਪੀਂਦੇ ਹਨ ਜਿੱਦਾਂ ਬੰਗਾਲ ਦੇ ਲੋਕ ਹੋ ਗਏ ਕਾਫ਼ੀ ਜਗ੍ਹਾ ਦੇ ਲੋਕ ਜਿਹੜੇ ਬਲੈਕ ਟੀ ਪੀਂਦੇ ਆ ਪਰ ਪੰਜਾਬ ਅੰਮ੍ਰਿਤਸਰ ਜਿੱਦਾਂ ਉੱਦਾਂ ਦੀ ਗੱਲ ਕਰੀਏ ਤਾਂ ਚਾਹ ਕਾਫ਼ੀ ਮਸ਼ਹੂਰ ਹੈਗੀ ਹਨ ਚਾਹ ਬਣਾਉਣ ਦਾ ਤਰੀਕਾ ਇਹ ਕਿ ਪਹਿਲਾਂ ਲੋਕ ਪਾਣੀ ਲੈਂਦੇ ਹਨ ਇੱਕ ਫਰਾਈ ਪੈਨ 'ਚ ਉਹਨੂੰ ਉਬਾਲ ਲੈਂਦੇ ਹਨ ਉਬਾਲ ਕੇ ਉਹਦੇ ਵਿੱਚ ਚੀਨੀ ਪਾਉਂਦੇ ਹਨ ਜਿੰਨੀ ਕੱਪ ਬਣਾਉਣੀ ਆ ਉੰਨੇ ਕੱਪ ਦੇ ਹਿਸਾਬ ਨਾਲ ਚੀਨੀ ਪਾ ਲੈਂਦੇ ਹਨ ਪੱਤੀ ਪਾ ਲੈਂਦੇ ਹਨ ਫਿਰ ਉਹਨੂੰ ਰੇਜਾ ਦਿਵਾਉਂਦੇ ਹਨ ਜਦੋਂ ਰੇਜਾ ਜਦੋਂ ਉਬਲ ਜਾਂਦੀ ਹੈ ਤਾਂ ਉਹਦੇ ਵਿੱਚ ਦੁੱਧ ਪਾ ਕੇ ਉਹਨੂੰ ਥੋੜ੍ਹੀ ਦੇਰ ਹੋਰ ਰੇਜਾ ਦਵਾ ਕੇ ਉਹ ਚਾਹ ਬਣ ਜਾਂਦੀ ਹੈ ਕਈ ਲੋਕ ਚਾਹ ਵਿੱਚ ਇਲਾਇਚੀ ਪਾਉਂਦੇ ਹਨ ਅਦਰਕ ਪਾਉਂਦੇ ਹਨ ਨਮਕ ਵੀ ਪਾਉਂਦੇ ਹਨ ਕਈ ਲੋਕ ਤਾਂ ਅਲੱਗ ਅਲੱਗ ਤਰ੍ਹਾਂ ਦੀ ਹਰ ਇੱਕ ਚੀਜ਼ ਕਈ ਟਾਈਮ ਦੇ ਅੱਜ ਦੇ ਟਾਈਮ ਜਦੋਂ ਚਾਹਵਾਂ ਹੀ ਅਲੱਗ ਅਲੱਗ ਤਰੀਕੇ ਦੀ ਬਨਣ ਲੱਗ ਪਈਆਂ ਹਨ ਜਿੱਦਾਂ ਕੋਈ ਚੋਕਲੇਟ ਚਾਹ ਬਣਾਉਣ ਲੱਗ ਪਿਆ ਕੋਈ ਪਾਨ ਦੀ ਚਾਹ ਬਣਾਉਣ ਲੱਗ ਪਿਆ ਗੁਲਾਬ ਟੀ ਬਣਾਉਣ ਲੱਗ ਪਿਆ ਹਰ ਤਰਾਂ ਦੀ ਲੋਕ ਚਾਹ ਬਣਾਉਂਦੇ ਹਨ ਕਾਫ਼ੀ ਜਿਹੜੀ ਚਾਹ ਹੈਨੀ ਜਿੱਦਾਂ ਗੁਲਾਬ ਟੀ ਹੈ ਜਿੱਦਾਂ ਉਹ ਚੀਜ਼ਾਂ ਵੀ ਕਾਫ਼ੀ ਸਵਾਦ ਹੁੰਦੀਆਂ ਹਨ ਕੁੱਲ੍ਹੜ ਵਿੱਚ ਚਾਹ ਲੋਕ ਪਹਿਲਾਂ ਕੱਚ ਦੇ ਗਲਾਸ ਵਿੱਚ ਚਾਹ ਪੀਂਦੇ ਹੁੰਦੇ ਆ ਅੱਜ ਕੱਲ੍ਹ ਬਾਹਰ ਮਾਰਕਿਟਾਂ 'ਚ ਜਾਓ ਅਤੇ ਕੁੱਲ੍ਹੜਾਂ ਵਿੱਚ ਚਾਹ ਮਿਲਦੀਆਂ ਪਈਆਂ ਕਿਉਂਕਿ ਕੁੱਲ੍ਹੜਾਂ ਵਿੱਚ ਚਾਹ ਪੀਣ ਦਾ ਇੱਕ ਅਲਗ ਨਜ਼ਾਰਾ ਹੈ ਕੁੱਲ੍ਹੜਾਂ ਵਿੱਚ ਕਾਫ਼ੀ ਅੱਛਾ ਲੱਗਦਾ ਚਾਹ ਪੀ ਕੇ ਘਰਾਂ ਵਿੱਚ ਚਾਹ ਤਾਂ ਬਹੁਤ ਪ੍ਰਸਿੱਧ ਹੈ ਘਰਾਂ ਵਿੱਚ ਤਾਂ ਲੋਕ ਰੋਟੀ ਖਾਣਗੇ ਉਹਦੇ ਨਾਲ ਚਾਹ ਪੀ ਲੈਣਗੇ ਕੁਛ ਕਰਨਗੇ ਉਹਦੇ ਨਾਲ ਚਾਹ ਪੀ ਲੈਣਗੇ ਹਰ ਚੀਜ਼ ਨਾਲ ਚਾਹ ਪੀਣੀ ਪੀਣੀ ਹੁੰਦੀ ਹੈ ਇਹਨਾਂ ਨੇ ਅਤੇ ਚਾਹ ਅੱਜ ਦੇ ਟਾਈਮ 'ਚ ਹਰ ਬੰਦੇ ਲਈ ਇੱਕ ਇਕ ਤਰ੍ਹਾਂ ਦੇ ਜੀਵਨ ਦਾ ਸਭ ਤੋਂ ਵੱਡੀ ਚੀਜ਼ ਬਣ ਗਈ ਕਿ ਚਾਹ ਪੀਣੀ ਪੀਣੀ ਹੈ ਕਈ ਲੋਕ ਚਾਹ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਚਾਹ ਪੀਣੀ ਪੀਣੀ ਹੈ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਦੋ ਲਿਆਂਦੇ ਹਨ ਆਪਣਾ ਆਪਣੀ ਦੁੱਧ ਲਿਆਣਗੇ ਅਤੇ ਚਾਹ ਬਣਾ ਲੈਣਗੇ ਅਤੇ ਹਰ ਚੀਜ਼ ਨਾਲ ਚਾਹ ਪੀਂਦੇ ਰਹਿੰਦੇ ਹਨ ਪਰ ਚਾਹ ਸਾਨੂੰ ਹੱਦ ਘੱਟ ਪੀਣੀ ਚਾਹੀਦੀ ਆ ਕਿਉਂਕਿ ਚਾਹ ਨੁਕਸਾਨ ਵੀ ਬਹੁਤ ਕਰਦੀ ਹੈ ਚਾਹ ਦੇ ਬਹੁਤ ਨੁਕਸਾਨ ਹੈ ਇਸ ਕਰਕੇ ਸਾਨੂੰ ਚਾਹ ਘੱਟ ਪੀਣੀ ਚਾਹੀਦੀ ਹਨ